ਜੇਕਰ ਦੇਖਿਆ ਜਾਵੇ ਤਾਂ ਕੁਦਰਤੀ ਆਫਤਾਂ ਜਾਂ ਵਾਤਾਵਰਨ ਸਬੰਧੀ ਘਟਨਾਵਾਂ ਤਾਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਹਨ ਕਿਉਂਕਿ ਜਿਹੜਾ ਹੁਣ ਤਾਂ ਮਨੁੱਖ ਆ ਉਹ ਥੋੜ੍ਹਾ ਜਿਹਾ ਕੁਦਰਤ ਨਾਲ ਜ਼ਿਆਦਾ ਛੇੜਛਾੜ ਕਰਦਾ ਹੈ ਜਿਸ ਨਾਲ ਵਾਤਾਵਰਨ ਵੀ ਖਰਾਬ ਹੁੰਦਾ ਹੈ ਅਤੇ ਕੁਦਰਤੀ ਗੱਲ ਹੈ ਕੁਦਰਤੀ ਆਫਤ ਵੀ ਜ਼ਿਆਦਾਤਰ ਆਉਂਦੀਆਂ ਹੀ ਰਹਿੰਦੀਆਂ ਹਨ ਉੱਨੀ ਸੌ ਬਨਵੇਂ ਦੇ ਵਿੱਚ ਜਦੋਂ ਕੁਦਰਤੀ ਆਫਤ ਹੜ੍ਹ ਆਇਆ ਸੀ ਉਹ ਮੈਂ ਆਪਣੀ ਅੱਖਾਂ ਘਟਨਾਵਾਂ ਅੱਖਾਂ ਨਾਲ ਦੇਖੀਆਂ ਹਨ ਉਸ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਸੀ ਇਤਿਹਾਸ ਦੇ ਵਿੱਚ ਮਤਲਬ ਇਕੋ ਦਰਜ ਹੋਣੇ ਵਾਲੀ ਚੀਜ਼ ਹੈਗੀ ਸੀ ਅਤੇ ਉਸ ਦੇ ਕਾਰਨ ਸੀਗਾ ਵੀ ਇਦਾਂ ਹੀ ਬਹੁਤ ਬਾਰਿਸ਼ ਹੋ ਗਈ ਸੀ ਬਹੁਤ ਜ਼ਿਆਦਾ ਮੀਂਹ ਪਏ ਸਨ ਉਸ ਸਾਲ ਅਤੇ ਪਟਿਆਲੇ ਦੇ ਵਿੱਚ ਕਾਫੀ ਜ਼ਿਆਦਾ ਉਹ ਹੜ੍ਹ ਆਏ ਸੀ ਉਦੋਂ ਅਸੀਂ ਪਿੰਡਾਂ ਦੇ ਵਿੱਚੋਂ ਪ੍ਰਸ਼ਾਦਾ ਪਾਣੀ ਇਕੱਠਾ ਕਰਕੇ ਲਿਜਾਂਦੇ ਰਹੇ ਮੱਝਾਂ ਲਈ ਗਾਵਾਂ ਲਈ ਜਾਂ ਕੋਈ ਹੋਰ ਹਰਾ ਚਾਰਾ ਵੀ ਲੈ ਕੇ ਜਾਂਦੇ ਰਹੇ ਸਨ ਅਤੇ ਉੱਥੇ ਬੜੇ ਘਰਾਂ ਦੇ ਘਰ ਤਬਾਹ ਹੋ ਗਏ ਸੀ ਬਹੁਤ ਬੁਰਾ ਹਾਲ ਸੀ ਮਤਲਬ ਖੜਿਆ ਨਹੀਂ ਸੀ ਜਾ ਰਿਹਾ ਉਸ ਤੋਂ ਬਾਅਦ ਉੱਥੇ ਬਿਮਾਰੀ ਵੀ ਫੈਲ ਗਈ ਸੀ ਕਿਉਂਕਿ ਕੁਝ ਮੱਝਾਂ ਕੁਝ ਇਨਸਾਨਾਂ ਦੀਆਂ ਉਥੇ ਮੌਤਾਂ ਹੋਈਆਂ ਸਨ ਰੁੜ ਗਏ ਸਨ ਪਾਣੀ ਨੇ ਬਹੁਤ ਤਬਾਹੀ ਮਚਾਈ ਸੀ ਸੋ ਇੱਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹੀਆਂ ਹਨ